ਮੈਂ ਕੱਲ੍ਹ ਬੋਰਡਰ ਗਿਆ ਜਿਸ ਵਿੱਚ ਮੈਂ ਫੋਟੋਜ਼ ਲਿਤੀਆਂ ਅਤੇ ਤਸਵੀਰਾਂ ਲਿਤੀਆਂ ਉੱਥੇ ਮੈਂ ਚੰਗੀਆਂ ਤਸਵੀਰਾਂ ਕੈਪਚਰ ਕੀਤੀਆਂ ਅਤੇ ਮੇਰਾ ਦਿਲ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਕਿਉਂਕਿ ਮੈਂ ਇਹ ਪਾਇਆ ਕਿ ਮੇਰੇ ਵਿੱਚ ਬਹੁਤ ਹੀ ਵਧੀਆ ਫੋਟੋਗ੍ਰਾਫੀ ਸਕਿੱਲ ਹੈ ਮੈਂ ਆਪਣੇ ਦੋਸਤ ਸੁਮਿਤ ਅਤੇ ਕਰਨ ਦੀਆਂ ਫੋਟੋਜ ਲਿਤੀਆਂ ਅਤੇ ਉਹਨਾਂ ਨੇ ਮੈਨੂੰ ਬਹੁਤ ਹੀ ਸ਼ਾਬਾਸ਼ੀ ਦਿੱਤੀ ਅਤੇ ਆਖਿਆ ਤੇਰੇ ਵਿੱਚ ਬਹੁਤ ਹੀ ਵਧੀਆ ਸਕਿੱਲ ਹੈ ਅਤੇ ਤੂੰ ਅੱਗੇ ਜਾ ਕੇ ਇੱਕ ਫੋਟੋਗ੍ਰਾਫਰ ਵੀ ਬਣ ਸਕਦਾ ਹੈ ਮੇਰਾ ਵੈਸੇ ਵੀ ਸ਼ੌਂਕ ਰਿਹਾ ਹੈ ਕਿ ਮੈਂ ਇਹ ਚੰਗੀਆਂ ਫੋਟੋਜ਼ ਕਲਿੱਕ ਕਰਕੇ ਸ਼ੋ ਕਰਾਵਾ ਆਪਣੇ ਟੈਲੈਂਟ ਨੂੰ ਸਮਾਜ ਵਿੱਚ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਚਾਅ ਹੈ ਫੋਟੋਜ ਦਾ ਆਪਣੀਆਂ ਫੋਟੋ ਲੈਂਦਾ ਅਤੇ ਫਰੈਂਡਸ ਦੀਆਂ ਫੋਟੋਜ਼ ਲੈਣ ਦਾ ਉਹਦੇ ਨਾਲ ਹੀ ਨੇਚਰ ਦੀਆਂ ਫੋਟੋਜ਼ ਲੈਣ ਦਾ ਮੈਂ ਅਤੇ ਮੇਰੇ ਦੋਸਤ ਜਿੱਥੇ ਵੀ ਜਾਂਦੇ ਹਾਂ ਅਤੇ ਮੇਰੇ ਦੋਸਤ ਮੈਨੂੰ ਪਹਿਲੇ ਪ੍ਰੈਫਰੈਂਸ ਦਿੰਦੇ ਹਨ ਕਿ ਮੈਂ ਉਹਨਾਂ ਦੀ ਫੋਟੋਆਂ ਖਿੱਚਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੇ ਵਿੱਚ ਫੋਟੋ ਖਿੱਚਣ ਦੀ ਬਹੁਤ ਹੀ ਵਧੀਆ ਸਕਿੱਲ ਮੌਜੂਦ ਹੈ